ਹੈਲੋ ਹਾਂਜੀ ਹੈਲੋ ਹਾਂਜੀ ਹਾਂਜੀ ਨਹੀਂ ਉਹ ਤਾਂ ਫੇਰ ਤੁਹ ਹਾਂਜੀ ਹਾਂਜੀ ਉਹਦੇ ਨਾਲ ਜਿਵੇਂ ਗਰੇ ਕੌਂਬੀਨੇਸ਼ਨ ਬਣ ਜੂਗਾ ਇੱਕ ਵਾਲ ਗਰੇ ਕਰਵਾ ਲਓ ਜਾਂ ਜੇ ਜ਼ਿਆਦਾ ਡਾਰਕ ਚਾਹੀਦਾ ਤਾਂ ਥਰੀ ਵਾਲਸ ਜਿਵੇਂ ਬਰੋ ਹੋ ਜਾਣੀਆਂ ਜਾਂ ਫਿਰ ਜਿਵੇਂ ਲਾਈਟ ਕਰਵਾਉਂਦੇ ਤਾਂ ਤਾਂ ਤਿੰਨ ਵਾਲ ਗਰੇ ਹਾਂਜੀ ਹਾਂਜੀ ਜਿਵੇਂ ਕਰੀਮਸ਼ ਹੋ ਜੂਗਾ ਨਾ ਯੈਲੋ ਲਾਈਟ ਹਾਂਜੀ ਹਾਂਜੀ ਹੋ ਜੂਗਾ ਇੱਕ ਵਾਲ 'ਤੇ ਜਿਵੇਂ ਕੋਈ ਮਤਲਬ ਫਲਾਰਜ਼ ਵਗੈਰਾ ਦਾ ਪੇਂ ਪੇਂਟ ਬਣਾ ਦੇਵਾਂਗੇ ਕਿੰਨੇ ਫਲੋਰ ਹੈ ਕਿੰਨੇ ਰੂਮ ਹੈ ਠੀਕ ਹੈ ਜੀ ਹਾਂਜੀ ਕੋਈ ਨਾ ਹੋ ਜੂਗਾ ਹਾਂਜੀ ਦੇਖੋ ਵੈਸੇ ਤਾਂ ਮਤਲਬ ਕਿ ਲਾਈਟ ਕਲਰ ਹੀ ਚੱਲ ਰਿਹਾ ਜਿਵੇਂ ਸੀ ਗਰੀਨ ਟਾਈਪ ਕਰਵਾ ਲਓ ਲਾਈਟ ਜਾਂ ਜਾਂ ਬਰਾਉਨ ਨਿਸਟਰ ਕਰਵਾ ਲਓ ਲਾਈਟ ਦਾ ਤੁਹਾਡੀ ਕੋਈ ਆਪਦੀ ਚੋਇਸ ਹਾਂਜੀ ਇਹ ਤਾਂ ਹੈ ਪਰ ਰੈਡ ਦੇ ਵਿੱਚ ਸਾਰੇ ਡਾਰਕ ਹੀ ਆਉਣਗੇ ਤੁਸੀਂ ਥੋੜ੍ਹਾ ਲਾਈਟ ਕਲਰ ਜ਼ਿਆਦਾ ਵਧੀਆ ਲੱਗਦੀ ਹੈ ਬਾਕੀ ਕੋਈ ਨਾ ਤੁਸੀਂ ਮੈਂ ਆਊਂਗਾ ਜਦੋਂ ਉਹ ਲੈ ਆਊਂਗਾ ਕੋਪੀ ਕਲਰਸ ਵਾਲੀ ਤੁਸੀਂ ਉਹਦੇ 'ਚ ਦੇਖ ਲਿਓ ਜਿਹੜੇ ਵੀ ਤੁਹਾਨੂੰ ਚੰਗਾ ਲੱਗੇਗਾ ਆਪਾਂ ਉਹ ਕਰ ਲਵਾਂਗੇ ਸਿਲੈਕਟ ਹਾਂਜੀ ਕੋਈ ਗੱਲ ਨਹੀਂ ਉਹ ਵੀ ਮੈਂ ਤੁਹਾਨੂੰ ਦਿਖਾ ਦਊਂ ਮਤਲਬ ਜੋ ਵੀ ਤੁਹਾਨੂੰ ਕਲਰ ਅੱਛਾ ਲੱਗੇਗਾ ਇਹ ਤਾਂ ਫਿਰ ਤੁਸੀਂ ਉਹਦੇ 'ਤੇ ਨੋਟਬੁਕ 'ਤੇ ਦੇਖੋਗੇ ਨਾ ਜਿਹਦੇ 'ਤੇ ਕਲਰਸ ਦਾ ਬਣਿਆ ਹੁੰਦਾ ਹਾਂਜੀ ਹਾਂਜੀ ਉਹ ਲਾਈਟ ਹੀ ਹੋਊਗਾ ਹਾਂਜੀ ਕਦੋਂ ਤੋਂ ਕਦੋਂ ਤੱਕ ਕਰਵਾਉਣਾ ਤੁਸੀਂ ਕਦੋਂ ਤੱਕ ਪੰਦਰ੍ਹਾਂ ਵੀਹ ਦਿਨ ਤਾਂ ਲੱਗਣਗੇ ਹੀ ਅਤੇ ਤੁਸੀਂ ਬਾਕੀ ਦੱਸ ਦਿਉ ਮੈਨੂੰ ਕਦੋਂ ਤੋਂ ਸਟਾ ਹਾਂਜੀ ਠੀਕ ਹੈ ਜੀ ਓਕੇ ਜੀ